ਮੈਨੂੰ ਬੁਣਾਈ ਵਾਲੀ ਚੀਜ਼ਾਂ ਬਹੁਤ ਪਸੰਦ ਹੈ ਮੈਂ ਉਹਨਾਂ ਦੇ ਨਵੇਂ ਨਵੇਂ ਨਵੇਂ ਨਵੇਂ ਤਰੀਕਿਆਂ ਨਾਲ ਕੁਛ ਵੀ ਬਣਾ ਲੈਂਦੀ ਹਾਂ ਮੈਂ ਉੱਨ ਦੇ ਉੱਨ ਨਾਲ ਸਵੈਟਰ ਬਣਾਉਣੇ ਬਹੁਤ ਪਸੰਦ ਕਰਦੀ ਹਾਂ ਨਵੇਂ ਨਵੇਂ ਡਿਜ਼ਾਇਨ ਦੇ ਸਵੈਟਰ ਬਣਾਉਂਦੀ ਹਾਂ ਮੈਂ ਅਤੇ ਇਸ ਇਹਨੂੰ ਉੱਨ ਨਾਲ ਮੈਂ ਪਲੇਅ ਥਾਲ ਦੀ ਕਵਰ ਵੀ ਬਣਾ ਲੈਂਦੀ ਹਾਂ ਅਤੇ ਮੈਂ ਇਸ ਨਾਲ ਨਵੀਆਂ ਨਵੀਆਂ ਲੜੀਆਂ ਵੀ ਬਣਾ ਲੈਂਦੀ ਹਾਂ ਮੈਨੂੰ ਇਹ ਬਹੁਤ ਕਰਨਾ ਬਹੁਤ ਹੀ ਪਸੰਦ ਹੈ ਅਤੇ ਇਸ ਨਾ ਇਹ ਇਸ ਨਾਲ ਮੈਂ ਅਲੱਗ ਅਲੱਗ ਤਰੀਕੇ ਦੇ ਨਵੀਆਂ ਨਵੀਆਂ ਚੀਜ਼ਾਂ ਤਿਆਰ ਕਰ ਸਕਦੀ ਹਾਂ ਜਿਹੜੀਆਂ ਮੈਨੂੰ ਬਹੁਤ ਹੀ ਵਧੀਆ ਲੱਗਦੀਆਂ ਹਨ ਅਤੇ ਮੈਂ ਅਲੱਗ ਅਲੱਗ ਡਿਜ਼ਾਇਨ ਨਾਲ ਤਿਆਰ ਕਰ ਸਕਦੀ ਹਾਂ ਅਤੇ ਸੋ ਮੈਨੂੰ ਸਿਲਾਈ ਕਰਨੀ ਬਹੁਤ ਪਸੰਦ ਹੈ ਮੈਂ ਸੂਤੀ ਕੱਪੜਿਆਂ ਦੇ ਅਲੱਗ ਅਲੱਗ ਡਿਜ਼ਾਇਨ ਨਾਲ ਮੈਂ ਸੂਟ ਤਿਆਰ ਕਰਦੀ ਹਾਂ ਮੈਨੂੰ ਡਿਜ਼ਾਇਨ ਕੱਪੜੇ ਬਣਾਉਣਾ ਬਹੁਤ ਹੀ ਪਸੰਦ ਹੈ ਮੈਂ ਉਹਨਾਂ ਵਿੱਚ ਅਲੱਗ ਅਲੱਗ ਡਿਜ਼ਾਇਨ ਪਾ ਕੇ ਉਹਨਾਂ ਨੂੰ ਨਵੇਂ ਤਰੀਕੇ ਨਾਲ ਤਿਆਰ ਕਰਕੇ ਮੈਂ ਵੇਖ ਤਿਆਰ ਕਰਕੇ ਵੇਚਦੀ ਹਾਂ ਜਿਹੜੇ ਅੱਗੇ ਕਸਟਮਰਾਂ ਨੂੰ ਬਹੁਤ ਹੀ ਵਧੀਆ ਲੱਗਦੇ ਹਨ ਅਤੇ ਉਹ ਇਸ ਨੂੰ ਬਣਵਾਉਣ ਵਾਸਤੇ ਔਡਰ ਲੈ ਕੇ ਆਉਂਦੇ ਹਨ ਮੇਰੇ ਕੋਲ ਅਤੇ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾ ਨੂੰ ਤਿਆਰ ਕਰਦੀ ਹਾਂ ਅਤੇ ਤੇਜ਼ੀ ਨਾਲ ਕਰਦੀ ਹਾਂ ਜਿਸ ਨਾਲ ਕਸਟਮਰ ਨੂੰ ਕੋਈ ਤਕਲੀਫ ਨਾ ਹੋਵੇ ਧੰਨਵਾਦ